ਹਾਂ ਮੈਂ ਚਿੱਤਰਕਾਰੀ ਦੀ ਕਲਾਸ ਲਗਾਈ ਹੈ ਮੈਂ ਮਾਨਸਾ ਵਿੱਚ ਹੀ ਚਿੱਤਰਕਾਰੀ ਦੀ ਕਲਾਸ ਲਗਾਉਣੀ ਸਟਾਰਟ ਕੀਤੀ ਸੀ ਜਿੱਥੇ ਸਿਲਾਈ ਕਢਾਈ ਸੂਟ ਪੇਂਟਿੰਗ ਕਰਵਾਏ ਜਾਂਦੀ ਸੀ ਉੱਥੇ ਮੈਨੂੰ ਹਰ ਇੱਕ ਤਰ੍ਹਾਂ ਦੇ ਕੱਪੜੇ 'ਤੇ ਕਿਵੇਂ ਪੇਂਟ ਕਰਨਾ ਹੈ ਇਸ ਬਾਰੇ ਦੱਸਿਆ ਜਾਂਦਾ ਸੀ ਹਰ ਕੱਲਰ ਨੂੰ ਕਿਵੇਂ ਸੂਟ 'ਤੇ ਪੇਂਟ ਕਰਨਾ ਹੈ ਕਿਵੇਂ ਚਿੱਤਰਕਾਰੀ ਕਰਨੀ ਹੈ ਕਿਵੇਂ ਇਹ ਪੇਂਟਿੰਗ ਛਾਪਣੀ ਹੈ ਉਸ ਬਾਰੇ ਦੱਸਿਆ ਜਾਂਦਾ ਸੀ ਕਿਸ ਕੱਲਰ ਨੂੰ ਕਿਸ ਕੱਲਰ ਨਾਲ ਮੈਚ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਵੀ ਦੱਸਿਆ ਜਾਂਦਾ ਸੀ ਅਤੇ ਇਹ ਹਰ ਇੱਕ ਕੱਪੜੇ 'ਤੇ ਹੈ ਕਿੰਨਾ ਕੱਲਰ ਲੱਗਦਾ ਹੈ ਹੈ ਕਿੰਨਾ ਕੱਲਰ ਲੱਗ ਕੇ ਇਸ ਤੋਂ ਬਾਅਦ ਕਿੰਨੇ ਟਾਈਮ ਦੇ ਵਿੱਚ ਉਹ ਪੇਂਟਿੰਗ ਪੂਰੀ ਸੁੱਕ ਸਕਦੀ ਹੈ ਅਤੇ ਕਿੰਨੇ ਟਾਈਮ ਦੇ ਵਿੱਚ ਉਹ ਪੇਂਟਿੰਗ ਪੂਰੀ ਪ੍ਰੋਪਰ ਤਿਆਰ ਹੋ ਸਕਦੀ ਹੈ ਉਹਦੇ ਬਾਰੇ ਵੀ ਦੱਸਿਆ ਜਾਂਦਾ ਸੀ ਇਸ ਤੋਂ ਇਲਾਵਾ ਮੈਂ ਜਿਵੇਂ ਖੂਹ 'ਤੇ ਪਾਣੀ ਭਰਦੀਆਂ ਮੁਟਿਆਰਾਂ ਦੀ ਚਿੱਤਰਕਾਰੀ ਵੀ ਕਰੀ ਹੈ ਇਹਨਾਂ ਵਿੱਚ ਮੈਂ ਵਟਰਪਰੂਫ ਕੱਲਰ ਹੀ ਯੂਜ਼ ਕਰਦੀ ਸੀ ਕਿ ਇਸ ਲਈ ਮੈਨੂੰ ਬਹੁਤ ਹੀ ਚਿੱਤਰਕਾਰੀ ਵਿੱਚ ਇੰਟਰਸਟ ਹੈ ਅਤੇ ਮੈਂ ਬਹੁਤ ਹੀ ਚਾਅ ਨਾਲ ਚਿੱਤਰਕਾਰੀ ਕਰਦੀ ਹਾਂ ਧੰਨਵਾਦ